ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਮੈਂ ਕਿਹਾ ਤੁਹਾਡਾ ਫੋਨ ਆ ਗਿਆ ਅੱਜ ਕਿਵੇਂ ਬੜੀ ਦੇਰ ਬਾਅਦ ਆਇਆ ਹੈਂ ਕਿੱਥੇ ਰਹਿੰਦੇ ਹੋ ਕਿੱਥੇ ਰਹਿੰਦੇ ਹੋ ਹੋਰ ਹੋਰ ਸਿਹਤ ਬਿਲਕੁਲ ਠੀਕ ਹੈ ਹੋਰ ਅੱਜ ਕਿਵੇਂ ਅੱਜ ਕਿਵੇਂ ਯਾਦ ਕੀਤਾ ਜੀ ਅੱਛਾ ਅੱਛਾ ਮੋਸਟ ਵੈਲਕਮ ਨਾ ਨਾ ਨਾ ਜੀ ਕਰਦੀ ਹਾਂ ਘਰੀਂ ਆ ਮੋਸਟ ਵੈਲਕਮ ਆਓ ਆਓ ਕਦੋਂ ਆ ਰਹੇ ਜੋ ਤੁਸੀਂ ਖਾਓਗੇ ਅਸੀਂ ਉਹੀ ਬਣਾ ਲੈਂਦੇ ਹਾਂ ਹਾਂ ਹਾਂ ਅੱਛਾ ਬਟ ਕਿਉਂ ਕੀ ਹੋ ਗਿਆ ਓ ਯਾਰ ਤੁਸੀਂ ਆ ਆ ਗਏ ਹੁੰਦੇ ਹਾਂ ਉਹ ਤੁਸੀਂ ਉਸ ਤੁਸੀਂ ਸਟੇਸ਼ਨ ਵਾਲੀ ਰੋਡ ਥਾਨੀ ਆਏ ਹੋਣੇ ਆ ਉੱਥੇ ਦੀ ਇੱਕ ਇੱਕ ਤਾਂ ਉਹ ਸਟੇਸ਼ਨ ਦਾ ਸਮਾਨ ਆਉਂਦਾ ਉੱਥੇ ਰੋਡ ਜਾਮ ਰਹਿੰਦੀ ਹੈ ਪਲਸ ਐਕਚੁਲੀ ਇੱਕ ਸਟੇਸ਼ਨ ਨਵਾਂ ਬਣ ਰਿਹਾ ਅਤੇ ਉਹਦੇ ਕਰਕੇ ਉਹ ਸਾਰੀ ਰੋਡ ਫੁੱਟੀ ਹੋਈ ਹੈ ਅਤੇ ਜਦੋਂ ਵੇਖੋ ਉੱਥੇ ਹਰ ਵੇਲੇ ਜਾਮ ਜਾਮ ਜਾਮ ਲੱਗਾ ਰਹਿੰਦਾ ਕੁਛ ਉਹ ਉਹ ਹਾਲੇ ਉਹ ਨਹੀਂ ਪਰੇਸ਼ਾਨੀ ਤਾਂ ਜ਼ਰੂਰ ਹੁੰਦੀ ਹੈ ਬਟ ਕਿਉਂ ਸਾ ਨਹੀਂ ਕਿਉਂ ਕਰਕੇ ਸਟੇਸ਼ਨ ਬਣ ਰਿਹਾ ਨਵਾਂ ਅਪਰੂਵਲ ਹੋਈ ਹੋਈ ਆ ਨਵਾਂ ਸਟੇਸ਼ਨ ਬਣ ਰਿਹਾ ਕੈਂਟ ਦਾ ਨਵਾਂ ਸਟੇਸ਼ਨ ਬਣ ਰਿਹਾ ਉਹਦੇ ਕਰਕੇ ਉਹ ਉਹਦੇ ਟਰੱਕਾਂ ਨੇ ਬਹੁਤ ਬਹੁਤ ਜ਼ਿਆਦਾ ਮੈਨੂੰ ਮੈਂ ਇਹ ਦੇਖੋ ਜੇ ਅਸੀਂ ਰਾਮਾ ਮੰਡੀ ਥਾਨੀ ਆਉਂਦੇ ਹਾਂ ਤਾਂ ਉੱਥੇ ਰਸਤਾ ਇੰਨਾ ਬਲੋਕੇਜ ਹੁੰਦੀ ਹੈ ਅਤੇ ਜੇ ਇਹਦੇ ਸਟੇਸ਼ਨ ਵੱਲੋਂ ਆਉਂਦੇ ਹਾਂ ਤਾਂ ਉੱਧਰ ਬਲੋਕੇਜ ਹੁੰਦੀ ਆ ਉੱਧਰ ਐਕਚੁਲੀ ਨਵਾਂ ਸਵੇਰੇ ਸਵੇਰੇ ਹਾਂ ਸਹੀ ਗੱਲ ਹੈ ਸਹੀ ਗੱਲ ਸਵੇਰੇ ਜੋਬ 'ਤੇ ਜਾਣਾ ਹੁੰਦਾ ਇਹਨਾਂ ਨੇ ਵੀ ਮੇਰੇ ਨਾਲ ਮੈਂ ਘਰੋਂ ਜਾ ਦਸ ਮਿਨਟ ਪਹਿਲਾਂ ਨਿਕਲਣਾ ਪੈਂਦਾ ਹੋਰ ਪਹਿਲਾਂ ਐਡਵਾਂਸ ਵਿੱਚ ਤਾਂ ਕਿ ਅੱਗੇ ਕੋਈ ਨਾ ਕੋਈ ਬਲੋਕੇਜ ਜਾਂ ਕੁਛ ਟਰੱਕ ਫਸਿਆ ਹੋਏਗਾ ਕੁਛ ਸਕੂਲ ਦੀ ਗੱਡੀ ਫਸੀ ਹੋਏਗੀ ਕੋਈ ਨਾ ਕੋਈ ਪ੍ਰੋਬਲਮ ਹੀ ਰਹਿੰਦੀ ਹੈ ਅਤੇ ਇਹ ਹਾਂ ਹੋਰ ਐ ਜਿੰਨੀ ਦੇਰ ਨੂੰ ਹੁਣ ਐਕਚੁਲੀ ਕਿ ਸਟੇਸ਼ਨ ਬਣ ਨਹੀਂ ਜਾਂਦਾ ਨਾ ਇਸ ਗੱਲ ਦਾ ਰਸਤਾ ਹੈਗਾ ਰਾਮਾ ਮੰਡੀ ਰਾਮਾ ਮੰਡੀਓਂ ਜੇ ਆਓ ਤਾਂ ਗਲੀਆਂ ਵਿੱਚੋਂ ਆ ਜਾਓ ਗਲੀਆਂ ਵਿੱਚ ਆਓ ਅਤੇ ਉਹਦਾ ਜਾਮ ਲੱਗਾ ਹੁੰਦਾ ਦੋ ਕਾਰਾਂ ਜਾਂ ਸਕੂਲ ਬਸਿਸ ਆਪਸ ਵਿੱਚ ਦੋ ਜਾ ਹੀ ਨਹੀਂ ਸਕਦੀਆਂ ਜਗ੍ਹਾ ਥੋੜ੍ਹੀ ਆ ਉਹਦੇ ਕਰਕੇ ਪ੍ਰੋਬਲਮ ਹੈ ਐਂ ਹੁਣ ਐਂ ਹਾਂ ਤੁਸੀਂ ਹਾਂ ਉਸ ਉਸ ਵੇਲੇ ਫਾਟਕ ਵੀ ਖੁੱਲ੍ਹਾ ਹੁੰਦਾ ਨਹੀਂ ਤਾਂ ਅੱਜ ਸ਼ਾਮ ਦੇ ਟਾਈਮ ਆਓਗੇ ਫਾਟਕ ਬੰਦ ਹੁੰਦਾ ਫਾਟਕ 'ਤੇ ਕਈ ਟਰੇਨਸ ਹਾਂ ਹਾਂ ਹਾਂ ਹਾਂ ਹਾਂ ਸਹੀ ਗੱਲ ਹੈ ਹਾਂ ਕੋਈ ਨਹੀਂ ਤੁਸੀਂ ਹਾਂ ਹਾਂਜੀ ਤੁਸੀਂ ਨਹੀਂ ਨਹੀਂ ਨਹੀਂ ਤੁਸੀਂ ਇੰਝ ਕਰਨਾ ਕਿ ਫਾਟਕ ਵੱਲੋਂ ਆ ਜਾਣਾ ਉਹ ਵੀ ਦੁਪਹਿਰ ਦੇ ਟਾਈਮ ਸ਼ਾਮ ਨੂੰ ਤਾਂ ਬਹੁਤ ਗੱਡੀਆਂ ਦਾ ਆਵਾਜਾਈ ਸ਼ੁਰੂ ਹੋ ਜਾਂਦੀ ਹੈ ਫਿਰ ਅੱਧਾ ਅੱਧਾ ਘੰਟਾ ਫਾਟਕ ਬੰਦ ਰਹਿੰਦਾ ਠੀਕ ਹੈ ਨਾ ਉਹਦੇ ਕਰਕੇ ਤੁਸੀਂ ਦੁਪਹਿਰ ਕੁ ਵੇਲੇ ਆ ਜਾਣਾ ਨਾਲ ਖਾਣਾ ਬਾਣਾ ਬਣਾ ਕੇ ਰੱਖਾਂਗੇ ਖਾ ਕੇ ਜਾਣਾ ਠੀਕ ਹੈ ਹੋਰ ਠੀਕ ਠਾਕ ਬੱਚੇ ਠੀਕ ਭਾਅ ਜੀ ਠੀਕ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ ਓਕੇ ਓਕੇ ਓਕੇ ਥੈਂਕ ਯੂ ਜੀ ਮੋਸਟ ਵੈਲਕਮ ਸਤਿ ਸ਼੍ਰੀ ਅਕਾਲ